ਸਤਿ ਸ਼੍ਰੀ ਅਕਾਲ ਜੀ ਮੀਸ਼ੋ ਤੋਂ ਬੋਲਦੇ ਹੋ ਮੈਂ ਦੋ ਮਹੀਨੇ ਪਹਿਲਾਂ ਸਾੜੀ ਮੰਗਵਾਈ ਸੀ ਜਿਹੜੀ ਮੈਨੂੰ ਬਿਲਕੁਲ ਪਸੰਦ ਨਹੀਂ ਆਈ ਜਦੋਂ ਮੈਨੂੰ ਉਹ ਮਿਲੀ ਤਾਂ ਉਸਦੀ ਪੈਕਿੰਗ ਬਹੁਤ ਘਟੀਆ ਸੀ ਪੈਕਿੰਗ ਖੋਲ੍ਹੀ ਤਾਂ ਸਾੜੀ ਦਾ ਰੰਗ ਵੀ ਬਹੁਤ ਚੇਂਜ ਹੋਇਆ ਹੋਇਆ ਸੀ ਜੋ ਮੈਂ ਸਾੜੀ ਮੰਗਵਾਈ ਸੀ ਉਹ ਬਿਲਕੁਲ ਚੇਂਜ ਸੀ ਉਸ ਦਾ ਰੇਟ ਮਾਰਕਿਟ ਨਾਲੋਂ ਬਹੁਤ ਹਾਈ ਸੀ ਉਹ ਮੇਰੇ ਪਾਈ ਬਿਲਕੁਲ ਵੀ ਜੱਚ ਨਹੀਂ ਰਹੀ ਸੀ ਮੇਰੇ ਘਰਦਿਆਂ ਨੇ ਵੀ ਮੈਨੂੰ ਗਾਲਾਂ ਕੱਢੀਆਂ ਅੱਗੇ ਤੋਂ ਮੈਂ ਤੁਹਾਡੇ ਤੋਂ ਕੁਝ ਵੀ ਨਹੀਂ ਮੰਗਵਾਉਣਾ